ਹਾਂਜੀ ਸਰ ਸਤਿ ਸ਼੍ਰੀ ਅਕਾਲ ਸਰ ਤੁਸੀਂ ਨਵਾਂਸ਼ਹਿਰ ਟੈਕਸੀ ਸਟੈਂਡ ਤੋਂ ਹੀ ਬੋਲ ਰਹੇ ਹੋ ਨਾ ਸਰ ਮੈਂ ਇੰਦਰਜੀਤ ਕੌਰ ਬੋਲ ਰਹੀ ਹਾਂ ਨਵਾਂਸ਼ਹਿਰ ਤੋਂ ਹੀ ਮੈਂ ਤੁਹਾਡੇ ਟੈਕਸੀ ਸਟੈਂਡ ਤੋਂ ਇੱਕ ਟੈਕਸੀ ਬੁੱਕ ਕਰਵਾਈ ਸੀ ਅੰਮ੍ਰਿਤਸਰ ਜਾਣ ਲਈ ਅਸੀਂ ਐਤਵਾਰ ਜਾਣਾ ਸੀ ਅਤੇ ਪਰ ਅਚਾਨਕ ਹੀ ਮਤਲਬ ਇੱਕ ਘਰ 'ਚ ਜ਼ਰੂਰੀ ਕੰਮ ਆਉਣ ਕਰਕੇ ਸਾਡਾ ਉਹ ਪ੍ਰੋਗਰਾਮ ਕੈਂਸਲ ਹੋ ਗਿਆ ਅਤੇ ਤੁਹਾਡੇ ਰੂਲ ਦੇ ਮੁਤਾਬਕ ਮੈਂ ਤੋਨੂੰ ਪੰਜਾਹ ਪ੍ਰਸੈਂਟ ਪਹਿਲਾਂ ਹੀ ਪੇਅ ਕਰ ਚੁੱਕੀ ਸੀ ਸਰ ਉਹ ਵਾਲਾ ਅਤੇ ਹੁਣ ਸਾਡਾ ਪ੍ਰੋਗਰਾਮ ਕੈਂਸਲ ਹੈ ਤਾਂ ਕੀ ਤੁਸੀਂ ਮੇਰਾ ਉਹ ਕੈਸ਼ ਬੈਕ ਕਰ ਦਉਂਗੇ ਪਲੀਜ਼ ਫਿਲਹਾਲ ਸਾਡਾ ਪ੍ਰੋਗਰਾਮ ਜਦੋਂ ਵੀ ਦੁਬਾਰਾ ਬਣਿਆ ਤਾਂ ਮੈਂ ਦੁਬਾਰਾ ਤੁਹਾਡੇ ਕੋਲੋਂ ਹੀ ਟੈਕਸੀ ਬੁੱਕ ਕਰਾ ਲਵਾਂਗੀ ਅਤੇ ਮੈਨੂੰ ਬਸ ਇਹ ਦੱਸਿਓ ਕਿ ਤੁਸੀਂ ਮੈਨੂੰ ਕਿਵੇਂ ਉਹ ਮੇਰਾ ਕੈਸ਼ ਬੈਕ ਕਰੂੰਗੇ ਜਿਹੜਾ ਮੈਂ ਮੈਂ ਫਿੱਫਟੀ ਪ੍ਰਸੈਂਟ ਪਹਿਲਾਂ ਕਰਵਾਇਆ ਹੋਇਆ ਅਤੇ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਸੁਵਿਧਾ ਜਨਕ ਹੈਗਾ ਤਾਂ ਪਲੀਜ਼ ਮੇਰਾ ਕੈਸ਼ ਬੈਕ ਵਾਪਸ ਕਰ ਦਿਉ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ